ਪਨੀਰ ਦੀ ਸਬਜ਼ੀ ਤਿਆਰ ਕਰਨ ਲਈ ਪਹਿਲਾਂ ਦੇਸੀ ਘਿਓ ਵਿੱਚ ਜ਼ੀਰੇ ਦਾ ਤੜਕਾ ਲਾ ਕੇ ਉਸ ਵਿੱਚ ਗ ਉਸ ਵਿੱਚ ਕ ਕੱਟਿਆ ਹੋਇਆ ਪਿਆਜ਼ ਪਿਆਜ਼ ਟਮਾਟਰ ਅਤੇ ਹੋਰ ਚੀ ਚੀਜ਼ਾਂ ਪਾ ਕੇ ਉਸ ਵਿੱਚ ਗਰਮ ਮਸਾਲਾ ਪਾ ਕੇ ਉਸਨੂੰ ਚੰਗੀ ਤਰ੍ਹਾਂ ਰਿੰਨ ਲਿਆ ਜਾਵੇ ਅਤੇ ਇਸਨੂੰ ਰਿੰਨਣ ਤੋਂ ਬਾਅਦ ਇਸ ਵਿੱਚ ਆਪਣੀ ਸੁਆਦ ਅਨੁਸਾਰ ਨਮਕ ਅਤੇ ਮਿਰਚ ਪਾ ਦਿੱਤੀ ਜਾਵੇ ਨਾਲ ਕੱਟੀ ਹੋਈ ਮਿਰਚ ਭ ਪਾਉਣ ਨਾਲ ਉਸ ਵਿੱਚ ਹੋਰ ਜ਼ਿਆਦਾ ਸੁਆਦ ਆਉਂਦਾ ਹੈ ਇਸ ਤੋਂ ਬਾਅਦ ਉਸ ਵਿੱਚ ਪਨੀਰ ਨੂੰ ਰਲਾ ਦਿਆ ਜਾਵੇ ਅਤੇ ਉਸਨੂੰ ਚੰਗੀ ਤਰ੍ਹਾਂ ਘੁੰਮਾ ਦਿੱਤਾ ਜਾਵੇ ਜਿਸ ਕਾਰਨ ਉਸ ਵਿੱਚ ਸਵਾਦ ਇੱਕ ਤਰ੍ਹਾਂ ਦਾ ਰਹੇ ਅਤੇ ਉਸਨੂੰ ਕੁਝ ਸਮੇਂ ਤੱਕ ਪਕਾਇਆ ਜਾਵੇ ਅਤੇ ਬਾਅਦ ਵਿੱਚ ਉਹ ਤੁਹਾਡਾ ਖਾਣ ਨੂੰ ਤਿਆਰ ਹੋ ਜਾਵੇਗਾ